ਸਤਿ ਸ਼੍ਰੀ ਅਕਾਲ ਜੀ ਐਮਾਜ ਐਮਾਜ਼ੋਨ ਸਰਵਿਸ ਤੋਂ ਬੋਲ ਤੁਸੀਂ ਜੀ ਮੈਂ ਗੁਰਵਿੰਦਰ ਸਿੰਘ ਬੋਲ ਰਿਹਾ ਜੀ ਔਡਰ ਤਾਂ ਨਹੀਂ ਕੁਝ ਕਰਨਾ ਬੱਟ ਔਡਰ ਕੀਤਾ ਸੀਗਾ ਉਸ ਦੇ ਰਿਗਾਰਡਿੰਗ ਤੁਹਾਡੇ ਨਾਲ ਗੱਲ ਕਰਨੀ ਸੀਗੀ ਹਾਂਜੀ ਹਾਂਜੀ ਹਾਂ ਮੈਂ ਫ਼ੋਨ ਮੰਗਵਾਇਆ ਸੀਗਾ ਜੀ ਦੋ ਤਿੰਨ ਸਾਲ ਪਹਿਲਾਂ ਰੈੱਡਮੀ ਨੌਟ ਗਿਆਰਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਔਨਲਾਈਨ ਮੰਗਵਾਇਆ ਸੀਗਾ ਤੁਹਾਡੀ ਐਪ ਤੋਂ ਮਾਰਕੀਟ 'ਚ ਇਹਦਾ ਪ੍ਰਾਈਸ ਸੀਗਾ ਸਤਾਰਾਂ ਹਜ਼ਾਰ ਮੈਨੂੰ ਚੌਦਾਂ ਹਜ਼ਾਰ 'ਚ ਮਿਲਿਆ ਵੈਸੇ ਮੈਂ ਕਦੇ ਔਨਲਾਈਨ ਸ਼ੋਪਿੰਗ ਕੀਤੀ ਨਹੀਂ ਪਹਿਲੀ ਵਾਰੀ ਕੀਤੀ ਸੀ ਮੈਨੂੰ ਡਰ ਵੀ ਸੀ ਵੀ ਪਤਾ ਨਹੀਂ ਮੰਗਵਾਇਆ ਕੀ ਨਿਕਲੇਗਾ ਵਿੱਚੋਂ ਜਿਸ ਤਰ੍ਹਾਂ ਦਾ ਸੁਣਦੇ ਹਾਂ ਵੀ ਅੱਜ ਕੱਲ ਔਨਲਾਈਨ ਸ਼ੋਪਿੰਗ 'ਤੇ ਦਿੱਕਤ ਵੀ ਆਉਂਦੀਆਂ ਕਈ ਸਮੱਸਿਆਵਾਂ ਆਉਂਦੀਆਂ ਸੀ ਹਾਂ ਪਰ ਜਦੋਂ ਮੈਂ ਮੰਗਵਾਇਆ ਜੋ ਮੈਂ ਕਲਰ ਡਿਸਾਈਡ ਕੀਤਾ ਸੀ ਜੋ ਮੈਂ ਕਲਰ ਚੁਣਿਆ ਸੀ ਔਨਲਾਈਨ ਨੇਵੀ ਬਲੂ ਕਲਰ ਅਤੇ ਤੁਹਾਡੀ ਡਿਲੀਵਰੀ ਬੁਆਏ ਜਦੋਂ ਉਹਨੇ ਮੈਨੂੰ ਹੱਥ 'ਚ ਫੜਾਇਆ ਡੱਬਾ ਖੋਲ੍ਹ ਕੇ ਦੇਖਿਆ ਸੇਮ ਬਿਲਕੁਲ ਉਸੇ ਹੀ ਤਰ੍ਹਾਂ ਦਾ ਮੈਨੂੰ ਮੇਰਾ ਫ਼ੋਨ ਮਿਲਿਆ ਜਿਸ ਤਰੀਕੇ ਨਾਲ ਮੈਂ ਤੁਹਾਡੇ ਸਾਈਟ 'ਤੇ ਦੇਖਿਆ ਸੀਗਾ ਹੁਣ ਤੂੰ ਹਿਸਾਬ ਲਾ ਲਓ ਉਹ ਵੀ ਤਿੰਨ ਸਾਲ ਹੋ ਗਏ ਜੀ ਉਹਨੂੰ ਚਲਦੇ ਨੂੰ ਬਹੁਤ ਸੋਹਣਾ ਚੱਲ ਰਿਹਾ ਫ਼ੋਨ ਹਾਂ ਬਹੁਤ ਵਧੀਆ ਬਹੁਤ ਵਧੀਆ ਰੈੱਡਮੀ ਨੌਟ ਗਿਆਰਾਂ ਤਿੰਨ ਸਾਲ ਹੋ ਗਏ ਜੀ ਮੈਂ ਕਦੇ ਮਤਲਬ ਹੋਰ ਫ਼ੋਨ ਖਰੀਦਿਆ ਹੀ ਨਹੀਂ ਬਹੁਤ ਸੋਹਣਾ ਚੱਲੀ ਜਾਂਦਾ ਬਹੁਤ ਵਧੀਆ ਫੀਚਰਜ਼ ਹੈ ਇਹਦੇ ਵਿੱਚ ਬਿੱਲ ਵਿਲ ਗਰੰਟੀ ਵਰੰਟੀ ਸਭ ਬਿੱਲ ਵਗੈਰਾ ਅਜੇ ਵੀ ਮੇਰੇ ਕੋਲ ਪਿਆ ਇਹਦਾ ਬਹੁਤ ਵਧੀਆ ਚੱਲ ਰਿਹਾ ਹਾਂ ਇੱਕ ਗੱਲ ਹੋਰ ਦੱਸਣਾ ਇੱਕ ਵਾਰ ਸਾਡੇ ਨਾ ਜਿਹੜਾ ਦੈਨਿਕ ਏ ਸੀ ਹੈ ਉਹਦਾ ਨਾ ਰਿਮੋਟ ਗੁੰਮ ਹੋ ਗਿਆ ਰਿਮੋਟ ਗੁੰਮ ਹੋ ਗਿਆ ਅਤੇ ਏ ਸੀ ਕਿੱਦਾਂ ਔਨ ਕੀਤਾ ਜਾਵੇ ਤਾਂ ਮੈਂ ਯੂਟੀਊਬ 'ਤੇ ਦੇਖਿਆ ਸੀ ਵੀ ਰੈੱਡਮੀ ਫ਼ੋਨ ਦੇ ਵਿੱਚ ਇਹ ਸੁਪਲ ਉਪਲਬਧ ਹੈਗੀ ਹੈ ਵੀ ਤੁਸੀਂ ਆਪਣੇ ਫ਼ੋਨ ਦੇ ਨਾਲ ਏ ਸੀ ਔਨ ਕਰ ਸਕਦੇ ਹੋ ਤਾਂ ਉਸ ਦਿਨ ਮੈਂ ਇਹਨੂੰ ਕੋਸ਼ਿਸ਼ ਕਰਕੇ ਦੇਖੀ ਅਤੇ ਇਸ ਫ਼ੋਨ ਦੇ ਨਾਲ ਸਾਡਾ ਏ ਸੀ ਵੀ ਔਨ ਹੋ ਗਿਆ ਔਨ ਔਰ ਬੰਦ ਵੀ ਹੋ ਜਾਂਦਾ ਹੁਣ ਸਾਨੂੰ ਕਦੇ ਰਿਮੋਟ ਦੀ ਲੋੜ ਨਹੀਂ ਪਈ ਔਨ ਔਫ ਕਰਨ ਵਾਸਤੇ ਹਾਂ ਟੈਂਮਪਰੇਚਰ ਘਟਾਉਣ ਵਾਸਤੇ ਯੂਜ਼ ਕਰਦੇ ਰਹਿੰਦੇ ਹਾਂ ਇਸ ਕਰਕੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਵਧੀਆ ਪ੍ਰੋਡਕਟ ਸੀ ਤੁਹਾਡਾ